ਹੈਲੋ ਹੈਲੋ ਸਵੀਗੀ ਤੋਂ ਬੋਲਦੇ ਜੀ ਤੁਸੀਂ ਮੈਂ ਨਾ ਤੁਹਾਡੇ ਉਹ ਆਰਡਰ ਬੁੱਕ ਕੀਤਾ ਸੀ ਸ਼ਾਹੀ ਪਨੀਰ ਦਾ ਅਤੇ ਖੀਰ ਦਾ ਅਤੇ ਮੈਂ ਆਰਡਰ ਕਰਨ ਲੱਗੇ ਤੁਹਾਨੂੰ ਦੱਸਿਆ ਵੀ ਹੋਇਆ ਸੀ ਕਿ ਇਹਦੇ ਵਿੱਚ ਨਮਕ ਜ਼ਿਆਦਾ ਨਹੀਂ ਹੋਣਾ ਚਾਹੀਦਾ ਅਤੇ ਮਸਾਲੇ ਜ਼ਿਆਦਾ ਤੇਜ਼ ਨਹੀਂ ਹੋਣੇ ਚਾਹੀਦੇ ਪਨੀਰ ਦੇ ਵਿੱਚ ਅਤੇ ਡੈਵੀਟੀਜ਼ ਦੇ ਅਸੀਂ ਪੇਸ਼ੈਂਟ ਦੱਸਿਆ ਵੀ ਹੈ ਅਤੇ ਉਹ ਤੁਸੀਂ ਉਹ ਖੀਰ ਵਿੱਚ ਵੀ ਮਿੱਠਾ ਬਹੁਤ ਜ਼ਿਆਦਾ ਕੀਤੇ ਦਾ ਫਿਰ ਇਸ ਤਰ੍ਹਾਂ ਕਿ ਇਹ ਸਾਨੂੰ ਬਿਲਕੁਲ ਵੀ ਪਸੰਦ ਨਹੀਂ ਆਏ ਤੁਹਾਡੇ ਆਰਡਰ ਜਾਂ ਤਾਂ ਤੁਸੀਂ ਆਪਣੇ ਆਰਡਰ ਇਸ ਤਰ੍ਹਾਂ ਕਰੋ ਕਿ ਵਾਪਿਸ ਲੈ ਜਾਓ ਨਹੀਂ ਤਾਂ ਮੈਂ ਤੁਹਾਡੀ ਕੰਪਲੇਂਟ ਕਰਨੀ ਆ ਇਸ ਆਰਡਰ 'ਤੇ ਅਤੇ ਦੂਜੀ ਜੋ ਰੋਟੀਆਂ ਮੈਂ ਦਾ ਆਰਡਰ ਦਿੱਤਾ ਸੀ ਉਹ ਵੀ ਸਹੀ ਨਹੀਂ ਹੈ ਇੱਕਦਮ ਸੁੱਕੀਆਂ ਜੈਸੇ ਜਿੱਦਾਂ ਕਿ ਪੁਰਾਣੀਆਂ ਹੁੰਦੀਆਂ ਰੋਟੀਆਂ ਸੁੱਕੀਆਂ ਬਿਲਕੁਲ ਸੁੱਕ ਗਈ ਦੀਆਂ ਰੋਟੀਆਂ ਅਤੇ ਇਹ ਤੁਹਾਡਾ ਆਈ ਡੀ ਨੰਬਰ ਹੈਗਾ ਇੱਕ ਚਾਰ ਪੰਜ ਛੇ ਸੱਤ ਅੱਠ ਦੋ ਜੀਰੋ ਤੁਸੀਂ ਆਪਣਾ ਆਰਡਰ ਵਾਪਿਸ ਲੈ ਜਾਓ ਜਾਂ ਮੈਨੂੰ ਰਿਪਲੇਸਮੈਂਟ ਕਰੋ ਆਰਡਰ ਅਤੇ ਮੈਂ ਇਸ ਤੋਂ ਪਹਿਲਾਂ ਵੀ ਤੁਹਾਡੇ ਸਵੀਗੀ ਦਾ ਆਰਡਰ ਕੀਤਾ ਸੀ ਉਸ ਟਾਈਮ ਵੀ ਮੈਨੂੰ ਨਾ ਸਵੀਗੀ ਦਾ ਜਿਹੜਾ ਖਰਾਬ ਆਰਡਰ ਦੇ ਕੇ ਗਏ ਸੀ ਮੈਂ ਉਦੋਂ ਵੀ ਤੁਹਾਨੂੰ ਕਿਹਾ ਸੀ ਅਤੇ ਤੁਸੀਂ ਉਦੋਂ ਵੀ ਕਹਿੰਦੇ ਜੀ ਕੋਈ ਨਹੀਂ ਅੱਗੇ ਤੋਂ ਇਸ ਤਰ੍ਹਾਂ ਨਹੀਂ ਹੋਵੇਗਾ ਸਹੀ ਤੁਹਾਨੂੰ ਦੂਸਰਾ ਤੁਸੀਂ ਉਹ ਪੈਸਿਆਂ ਦਾ ਵੀ ਰਿਫੰਡ ਨਹੀਂ ਸੀ ਕੀਤਾ ਇਸ ਕਰਕੇ ਅਤੇ ਐਤਕੀ ਤੁਸੀਂ ਮੇਰੇ ਦੋਨੇ ਰੀਫੰਡ ਕਰੋ ਪੈਸੇ ਵੀ ਕਰੋ ਅਤੇ ਨਹੀਂ ਤਾਂ ਮੈਂ ਤੁਹਾਡੀ ਐਤਕੀ ਕੰਪਲੇਂਟ ਕਰਨੀ ਜੇ